ਹਾਂਜੀ ਗੁਰਦੁਆਰਾ ਰਾਮਸਰ ਤੋਂ ਗੱਲ ਕਰ ਰਹੇ ਜੀ ਹਾਂਜੀ ਸਰ ਮੈਂ ਗੁਰਦੁਆਰਾ ਸਾਹਿਬ ਆਉਣ ਦੀ ਪਲੈਨਿੰਗ 'ਚ ਸੀਗਾ ਮੈਂ ਥੋੜ੍ਹੀ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਕੀ ਤੁਸੀਂ ਮੈਨੂੰ ਜਾਣਕਾਰੀ ਦੇ ਸਕਦੇ ਹੋ ਜੀ ਹਾਂ ਸਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਆਉਣਾ ਸੀ ਸਾਡੀ ਸਿਰਫ ਦੋ ਤਿੰਨ ਦਿਨ ਲਈ ਸਾਡੀ ਸਟੇਅ ਹੋਏਗੀ ਇਸ ਗੁਰਦੁਆਰੇ 'ਚ ਅਤੇ ਮੈਂ ਸਟੇਅ ਦੇ ਰਿਗਾਰਡਿੰਗ ਪੁੱਛਣਾ ਸੀ ਵੀ ਆਪਣੇ ਕੋਲ ਰੂਮ ਵਗੈਰਾ ਅਵੇਲੇਬਲ ਹੈ ਨੇ ਗੁਰਦੁਆਰੇ 'ਚ ਓਕੇ ਜੀ ਅਤੇ ਰੂਮ ਹੈਗੇ ਨੇ ਇਹ ਕਿਦਾਂ ਰੂਮ ਮਤਲਬ ਇਹਨਾਂ ਦੇ ਸ ਪੂਰੀ ਸਫ਼ਾਈ ਸਫ਼ੂਈ ਅੱਛੀ ਹੁੰਦੀ ਇਹਨਾਂ 'ਚ ਏ ਸੀ ਵਗੈਰਾ ਦਾ ਹੈ ਕੋਈ ਪ੍ਰਬੰਧ ਕੀਤਾ ਹੋਇਆ ਓਕੇ ਨਹੀਂ ਮੈਨੂੰ ਕਮਰਾ ਮੈਨੂੰ ਏ ਸੀ ਹੀ ਚਾਹੀਦਾ ਹੋਵੇਗਾ ਅਤੇ ਮੈਨੂੰ ਇਸ ਤੋਂ ਇਲਾਵਾ ਮੈਨੂੰ ਹੋਰ ਦੱਸੋ ਤੁਹਾਡੇ ਗੁਰਦੁਆਰੇ ਦੇ ਵਿੱਚ ਖਾਣ ਪੀਣ ਦਾ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਹੈ ਜਾਂ ਕਿੰਨੇ ਕੁ ਟਾਈਮ ਜਾਂ ਟਾਈਮਿੰਗ ਓਕੇ ਮਤਲਬ ਦੋ ਤਿੰਨ ਟੈਮ ਦਾ ਖਾਣਾ ਦੇਖੋ ਅਸੀਂ ਤਿੰਨ ਜਾਂ ਚਾਰ ਦਿਨ ਲਈ ਸਟੇਅ ਕਰਨਾ ਇਸ ਲਈ ਸਾਨੂੰ ਮੈਂ ਮੇਰੀ ਫੈਮਲੀ ਨਾਲ ਹੋਵੇਗੀ ਤਾਂ ਲੰਗਰ ਵਗੈਰਾ ਦੀ ਸੁਵਿਧਾ ਅਗਰ ਹੋਵੇਗੀ ਤਾਂ ਬਹੁਤ ਵਧੀਆ ਗੱਲ ਹੈ ਅਤੇ ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਦੱਸੋਗੇ ਵੀ ਤੁਹਾਡੇ ਜਿਹੜਾ ਇਸ ਰੂਮ ਦਾ ਰੈਂਟ ਹੈ ਇਹ ਏਹ ਰੈਂਟ ਕੀ ਪੈਂਦਾ ਇਹਦਾ ਜੀ ਜੀ ਓਕੇ ਚਲੋ ਮੇਰੇ ਲਈ ਤੁਸੀਂ ਛੇ ਪਰਸਨ ਹੋਣਗੇ ਸਾਡੇ ਤੁਸੀਂ ਦੋ ਰੂਮ ਬੁੱਕ ਕਰਨਾ ਚਾਹੁੰਦਾ ਮੈਂ ਅਤੇ ਇਹਦੇ ਲਈ ਮੈਨੂੰ ਡਾਕੂਮੇਟੇਂਸ਼ਨ ਕੀ ਕੁਛ ਦੇਣਾ ਪੈਣਾ ਤੁਹਾਨੂੰ ਮਤਲਬ ਕੀ ਡਾਕੂਮੈਂਟ ਲੈ ਕੇ ਆਵਾਂ ਓਕੇ ਜੀ ਠੀਕ ਹੈ ਜੀ ਅਤੇ ਪੇਅਮੈਂਟ ਅਸੀਂ ਔਨਲਾਈਨ ਵੀ ਕਰ ਸਕਦੇ ਹਾਂ ਜਾਂ ਪੇਅਮੈਂਟ ਉੱਥੇ ਆ ਕੇ ਹੋਵੇ ਅੱਛਾ ਇੱਕ ਮੈਨੂੰ ਹੋਰ ਜਾਣਕਾਰੀ ਦਿਉ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਦੇਖਣ ਯੋਗ ਹੋਏ ਘੁੰਮਣ ਯੋਗ ਕੋਈ ਹੋਰ ਵੀ ਜਗ੍ਹਾ ਹੈਗੀ ਹੈ ਠੀਕ ਹੈ ਜੀ ਠੀਕ ਹੈ ਅੱਛਾ ਚਲੋ ਗੁਰਦੁਆਰਾ ਸਾਹਿਬ ਆਉਣ ਲਈ ਮੈਨੂੰ ਜਿਵੇਂ ਮੈਂ ਆਉਣਾ ਬਾਏ ਏਅਰ ਆਉਣਾ ਤਾਂ ਮੈਂ ਚੰਡੀਗੜ੍ਹ ਉੱਤਰਨਾ ਤਾਂ ਉਸ ਤੋਂ ਬਾਅਦ ਮੈਨੂੰ ਕਿਹੜੀ ਸੁਵਿਧਾ ਮਿਲੂ ਮੈਨੂੰ ਬੱਸ ਟੈਕਸੀ ਜਾਂ ਕੁਛ ਹੋਰ ਅਰੇਂਜ ਅਰੇਂਜਮੈਂਟ ਹੋ ਸਕਦਾ ਉੱਥੋਂ ਓਕੇ ਅਗਜੈਕਟਲੀ ਤੁਹਾਡਾ ਜਿਹੜਾ ਇਹ ਫ਼ੇਸ ਹੈਗਾ ਹੈ ਕਿਹੜੇ ਫ਼ੇਸ 'ਚ ਪੈਂਦਾ ਮੋਹਾਲੀ ਦੇ ਵਿੱਚ ਓਕੇ ਓਕੇ ਓਕੇ ਓਕੇ ਓਕੇ ਚਲੋ ਇਸ ਤਰ੍ਹਾਂ ਹੈਗਾ ਮੈਂ ਨਾ ਹੁਣ ਆਪਣਾ ਪਲੈਨ ਮੇਰਾ ਤਕਰੀਬਨ ਤਕਰੀਬਨ ਹੋ ਚੁੱਕਾ ਤੁਸੀਂ ਮੇਰੇ ਲਈ ਨਾ ਕਾਇੰਡਲੀ ਦੋ ਕਮਰੇ ਜਿਹੜੇ ਹੈਗੇ ਬੁੱਕ ਐਡਵਾਂਸ ਕਰ ਲਉ ਤੁਹਾਨੂੰ ਮੈਂ ਡਾਕੂਮੈਂਟਸ ਅਤੇ ਪੇਅਮੈਂਟ ਵਗੈਰਾ ਕਰ ਦਿੰਦਾ ਠੀਕ ਹੈ ਜੀ ਅਤੇ ਹਾਂ ਚਲੋ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਨਾਮ ਨਾਮ ਗੁਰਮੁਖ ਸਿੰਘ ਹੈ ਅਤੇ ਮੇਰੇ ਨਾਲ ਛੇ ਫੈਮਲੀ ਮੈਂਬਰ ਹੋਣਗੇ ਠੀਕ ਹੈ ਜੀ ਚਲੋ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਓਕੇ ਜੀ ਓਕੇ ਜੀ